ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਹਾਂਜੀ ਭਾਅ ਜੀ ਮੈਂ ਨਾ ਰੋਪੜ ਤੋਂ ਬੋਲ ਰਹੀ ਹਾਂ ਅਤੇ ਤੁਸੀਂ ਤੋਂ ਬੋਲ ਰਹੇ ਹੋ ਹਾਂਜੀ ਮੈਂ ਨਾ ਤੁਹਾਡੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਇਸ ਗਲੀ 'ਚ ਨਾ ਬਰਸਾਤ ਦਾ ਪਾਣੀ ਕਾਫੀ ਇਕੱਠਾ ਹੋ ਜਾਂਦਾ ਸਾਨੂੰ ਇਸ ਵਾਰ ਬਹੁਤ ਸਮੱਸਿਆ ਆ ਰਹੀ ਆ ਜਿੱਦਾਂ ਬਰਸਾਤ ਦਾ ਪਾਣੀ ਸਾਡੇ ਅੰਦਰ ਘਰਾਂ ਤੱਕ ਚੱਲ ਜਾਂਦਾ ਅਤੇ ਗਲੀ 'ਚ ਵੀ ਕਾਫੀ ਇਕੱਠਾ ਹੋ ਜਾਂਦਾ ਜਿਹਦੇ ਕਰਕੇ ਨਾ ਸਾਡੇ ਬੈਡ ਵਗੈਰਾ ਕੋਈ ਵੀ ਸਾਰਾ ਸਮਾਨ ਨਾ ਗਿੱਲਾ ਹੋ ਜਾਂਦਾ ਅਤੇ ਗਲੀਆਂ 'ਚ ਵੀ ਪਾਣੀ ਇਕੱਠਾ ਹੋਣ ਕਰਕੇ ਇੱਥੇ ਮੱਛਰ ਕ ਕਾਫੀ ਪੈਦਾ ਹੋ ਜਾਂਦਾ ਅਤੇ ਜਿਸ ਕਰਕੇ ਨਾ ਫਿਰ ਸਾਡੇ ਕਈ ਜਣੇ ਬਿਮਾਰ ਵੀ ਹੋ ਰਹੇ ਆ ਡੇਂਗੂ ਮਲੇਰੀਆ ਵਗੈਰਾ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਲੋਕ ਅਤੇ ਮੈਂ ਨਾ ਨਗਰ ਕੌਂਸਲ 'ਚ ਵੀ ਕੰਪਲੇਂਟ ਕੀਤੀ ਪਰ ਉਹਨਾਂ ਨੇ ਸਾਡੀ ਕੋਈ ਵੀ ਕੰਪਲੇਂਟ ਸਵੀਕਾਰ ਨਹੀਂ ਕੀਤੀ ਨਾ ਹੀ ਕੋਈ ਇਸ 'ਤੇ ਕਾਰਵਾਈ ਕੀਤੀ ਹੈ ਅਤੇ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੀ ਜਿਹੜੀ ਸਮੱਸਿਆ ਆ ਅੱਗੇ ਤੱਕ ਪਹੁੰਚਾਓ ਇਹਦਾ ਕੋਈ ਹੱਲ ਨਿਕਲ ਹਾਂਜੀ ਹਾਂਜੀ ਨਹੀਂ ਬਸ ਇਹੀ ਸੀ ਕਿ ਚਲੋ ਥੋੜ੍ਹਾ ਸਾਫ ਸਫਾਈ ਵੱਲ ਥੋੜ੍ਹਾ ਹੋ ਜਾਂਦਾ ਜੇ ਵੀ ਇੱਥੇ ਬਿਮਾਰੀਆਂ ਵਗੈਰਾ ਮੱਛਰ ਵਗੈਰਾ ਪੈਦਾ ਹੁੰਦੇ ਆ ਉਹਦੇ ਤੋਂ ਹੀ ਸਮੱਸਿਆ ਹੱਲ ਹੋ ਜਾਂਦੀ ਪਾਣੀ ਇਕੱਠਾ ਹੋ ਜਾਂਦਾ ਪਾਣੀ ਦਾ ਕੋਈ ਨਿਕਾਸ ਹੋ ਜੇ ਪਾਣੀ ਨਿਕਲਣ ਦਾ ਹਾਂਜੀ

ਹਾਂਜੀ ਅਤੇ ਹੋਰ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜੇ ਉੱਥੇ ਤੁਸੀਂ ਇੱਕ ਵਾਰੀ ਨਗਰ ਕੋਸ ਇੱਥੇ ਆ ਕੇ ਇੱਥੇ ਚੈੱਕ ਵੀ ਕਰ ਸਕਦੇ ਹੋ ਵੀ ਇੱਥੇ ਦੇ ਹਾਲਾਤ ਕਿੰਨੇ ਮਾੜੇ ਹੋਏ ਆ ਹਾਂਜੀ ਠੀਕ ਹੈ ਓਕੇ ਫੇਰ ਥੈਂਕ ਯੂ

ਠੀਕ ਹੈ ਠੀਕ ਹੈ ਸਰ ਓਕੇ